ਕੋਵਿਡ ਨਾਇਨਟੀਨ ਮਹਾਂਮਾਰੀ ਨੇ ਸਾਡੇ ਇਲਾਕੇ ਵਿੱਚ ਯਾਤਰਾ ਅਤੇ ਸੈਰ ਸਪਾਟੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜੋ ਵਿਚਾਰੇ ਲੋਕ ਜਿੱਥੇ ਬੈਠੇ ਸੀ ਉੱਥੇ ਹੀ ਬੈਠੇ ਰਹਿ ਗਏ ਆਉਣਾ ਜਾਣਾ ਵੀ ਲੋਕਾਂ ਕੋਲ ਇੰਨਾ ਮੁਸ਼ਕਿਲ ਹੋ ਗਿਆ ਜਿਹੜੇ ਕੋਲਜਾਂ 'ਚ ਗਏ ਹੋਏ ਸੀ ਯੂਨੀਵਰਸਿਟੀ 'ਚ ਬਾਹਰ ਪੜ੍ਹਨ ਉਹਨਾਂ ਨੂੰ ਉੱਥੇ ਵੱਡੇ ਵੱਡੇ ਲੀਡਰਾਂ ਨੂੰ ਵਿੱਚ ਇੰਟਰਫੇਰ ਕਰਕੇ ਅਤੇ ਉੱਥੋਂ ਮੰਗਵਾਉਣਾ ਪਿਆ ਕਈਆਂ ਦੇ ਕੰਮ ਠੱਪ ਹੋ ਗਏ ਅਤੇ ਫਿਰ ਕਈ ਲੋਕਾਂ ਨੇ ਇਹ ਵੀ ਕੀਤਾ ਕਿ ਉਹਨਾਂ ਨੂੰ ਜਿਹੜੇ ਲੋਕ ਜਿਹਨਾਂ ਲੋਕਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਕਿਉਂਕਿ ਸਾਰੀਆਂ ਫੈਕਟਰੀਆਂ ਬੰਦ ਸੀ ਸਾਰਾ ਕੰਮ ਬੰਦ ਸੀ ਅਤੇ ਕਰਫਿਊ ਵਾਲੇ ਹਲਾਤ ਸੀ ਅਤੇ ਹਰ ਚੀਜ਼ ਨੂੰ ਮਿਲਣਾ ਮੁਸ਼ਕਿਲ ਹੋਇਆ ਹੋਇਆ ਸੀ ਅਤੇ ਕਈ ਜਿਹੜੇ ਦਾਨਵੀਰ ਹੈਗੇ ਸੀ ਲੋਕ ਉਹਨਾਂ ਨੇ ਰਾਸ਼ਨ ਵਗੈਰਾ ਜਾਂ ਕਈਆਂ ਨੂੰ ਲੋਕਾਂ ਨੂੰ ਪਹੁੰਚਾਉਣ ਦਾ ਕੰਮ ਹੋਰ ਕਾਫੀ ਕੰਮ ਉਹਨਾਂ ਨੇ ਕੀਤੇ ਅਤੇ ਥੋੜ੍ਹੀ ਲਾਈਫ ਸੌਖੀ ਬਣਾਉਣ ਦੀ ਕੀਤੀ ਪਰ ਸੈਰ ਸਪਾਟੇ ਅਤੇ ਯਾਤਰਾ ਤਾਂ ਉਸ ਟਾਈਮ 'ਤੇ ਬਹੁਤ ਹੀ ਮੁਸ਼ਕਿਲ ਸੀ ਕਿਉਂਕਿ ਘਰੋਂ ਨਿਕਲਣ 'ਤੇ ਹੀ ਬੜਾ ਬੈਨ ਹੈਗਾ ਸੀ ਅਤੇ ਫਿਰ ਸਾਰਾ ਕੁਛ ਤਾਂ ਬੰਦ ਹੋ ਗਿਆ ਸੀ ਉਹ ਇੱਕ ਬੜਾ ਹੀ ਸਾਡੇ ਇੰਡੀਆ ਵਿੱਚ ਕੜਵਾ ਅਨੁਭਵ ਕਹਿ ਸਕਦੇ ਹਾਂ ਅਸੀਂ ਕਿ ਲੋਕਾਂ ਨੂੰ ਕਈਆਂ ਨੂੰ ਜਿਹਨਾਂ ਨੂੰ ਕੰਮ ਨਹੀਂ ਮਿਲਿਆ ਵਿਚਾਰਿਆਂ ਨੂੰ ਉਹਨਾਂ ਨੂੰ ਆਤਮ ਹੱਤਿਆ ਵੀ ਕਰਨੀ ਪਈ ਕਿਉਂਕਿ ਪੈਸੇ ਦੀ ਜਿੱਥੇ ਤੰਗੀ ਹੋਏਗੀ ਉੱਥੇ ਕਈ ਵਾਰੀ ਪੈਸੇ ਦੀ ਕਮੀ ਕੋਈ ਕ ਥੋੜ੍ਹੀ ਦੇਰ ਪੂਰੀ ਕਰ ਸਕਦਾ ਜ਼ਿਆਦਾ ਦੇਰ ਨਹੀਂ ਪੂਰੀ ਕਰ ਸਕਦਾ ਅਤੇ ਕੰਮ ਮਿਲਣਾ ਵੀ ਲੋਕਾਂ ਨੂੰ ਬੰਦ ਹੋ ਗਿਆ ਅਤੇ ਇਸ ਇਹਦੇ ਵਿੱਚ ਆਤਮਹੱਤਿਆ ਵੀ ਲੋਕਾਂ ਨੂੰ ਕਾਫੀ ਕਰਨੀ ਪਈ ਕੰਮ ਕਾਫੀ ਲੋਕਾਂ ਦੇ ਛੁੱਟ ਗਏ ਔਰ ਐ ਕਦੀ ਵੀ ਨਾ ਹੋਵੇ ਹੁਣ ਸਾਡੇ ਦੇਸ਼ 'ਚ ਕਦੇ ਵੀ ਕੋਵਿਡ ਨਾ ਆਵੇ ਅਤੇ ਇਹ ਲੋਕਾਂ ਨੂੰ ਫਿਰ ਦੁਬਾਰਾ ਇਹੋ ਜਿਹੀ ਮੁਸੀਬਤ 'ਚੋਂ ਸਾਹਮਣਾ ਨਾ ਕਰਨਾ ਪਵੇ ਮੇਰੀ ਤਾਂ ਰੱਬ ਤੋਂ ਇਹੀ ਪ੍ਰਾਰਥਨਾ ਹੈ